ਸੱਤ ਸਤੰਬਰ ਉੱਨੀ ਸੌ ਚੁਰਾਨਵੇਂ ਦੋ ਨਵੰਬਰ ਦੋ ਹਜ਼ਾਰ ਦੋ ਸਤਾਈ ਅਪ੍ਰੈਲ ਉੱਨੀ ਸੌ ਇਕਹੱਤਰ ਸੱਤ ਅਪ੍ਰੈਲ ਉੱਨੀ ਸੌ ਪੈਂਹਠ ਸੋਲਾਂ ਨਵੰਬਰ ਦੋ ਹਜ਼ਾਰ ਤੇਈ